ਜਦੋਂ ਅਸੀਂ ਖਾਣਾ ਬਣਾਉਣ ਲੱਗਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਸਾਡੇ ਕੋਲ ਜਿਹੜੀ ਖਾਣਾ ਪਕਾਉਣ ਵਾਸਤੇ ਮਟੀਰੀਅਲ ਅ ਜਿਵੇਂ ਕਿ ਦਾਲਾਂ ਦਾਲਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਉਹਨਾਂ ਵਿੱਚ ਕਈ ਵਾਰ ਕੱਚੇ ਪੱਥਰ ਜਿਵੇਂ ਮਿੱਟੀ ਵਾਲੇ ਜਾਂ ਪੱਕੇ ਪੱਥਰ ਵੀ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰ ਦਿੰਦੇ ਹਾਂ ਕੱਢ ਦਿੰਦੇ ਹਾਂ ਵਿੱਚੋਂ ਚਾਵਲ ਵੀ ਸਾਫ਼ ਕਰਦੇ ਹਾਂ ਜੇ ਅਸੀਂ ਸਬਜ਼ੀਆਂ ਬਣਾਉਣੀਆਂ ਕੋਈ ਤਾਂ ਸਬਜ਼ੀ ਨੂੰ ਪਹਿਲਾਂ ਚੰਗੀ ਤਰ੍ਹਾਂ ਧੋਵਾਂਗੇ ਕਿਉਂਕਿ ਅੱਜ ਕੱਲ੍ਹ ਕੀਟਨਾਸ਼ਕਾਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਇਸ ਤੋਂ ਇਲਾਵਾ ਅਸੀਂ ਸਬਜ਼ੀਆਂ ਨੂੰ ਕੱਟ ਕੇ ਵੀ ਧੋ ਸਕਦੇ ਹਾਂ ਜਾਂ ਪਹਿਲਾਂ ਵੀ ਧੋ ਲੈ ਅਸੀਂ ਧੋ ਲੈਂਦੇ ਹਾਂ ਹੈ ਨਾ ਮੋਸਟਲੀ ਫਿ ਫਿਰ ਇਹਨੂੰ ਗਰਮ ਪਾਣੀ ਵਿੱਚ ਵੀ ਧੋ ਲਈਦਾ ਆ ਫਿਰ ਅਸੀਂ ਖਾਣਾ ਪਕਾਉਂਦੇ ਸਮੇਂ ਇਹ ਸਾਵਧਾਨੀ ਜ਼ਰੂਰ ਰੱਖਦੇ ਹਾਂ ਕਿ ਜੇ ਖਾਣਾ ਬਿਲਕੁਲ ਢੱਕ ਕੇ ਪਕਾਉਂਦੇ ਜਿਵੇਂ ਅਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਅਸੀਂ ਤਾਂ ਸਿਰ ਵੀ ਢੱਕ ਲੈਂਦੇ ਹਾਂ ਕਿਤੇ ਵਾਲ ਵੂਲ ਕਿਸੇ ਤਰ੍ਹਾਂ ਦਾ ਨਾ ਬੱਚਿਆਂ ਨੂੰ ਫਲੇਮ ਤੋਂ ਦੂਰ ਰੱਖੀਦਾ ਅੱਗ ਤੋਂ ਪੂਰੀ ਤਰ੍ਹਾਂ ਖਾਣਾ ਪਕਾਉਂਦੇ ਸਮੇਂ ਅਸੀਂ ਹਰ ਚੀਜ਼ ਮਸਾਲੇ ਦੀ ਹਰ ਲੂਣ ਮਿਰਚ ਹਰ ਚੀਜ਼ ਦੀ ਸਹੀ ਵਰਤੋਂ ਕਰਦੇ ਹਾਂ ਫਿਰ ਤੇਲ ਅਸੀਂ ਵਧੀਆ ਕਿਸਮ ਦਾ ਵਰਤਦੇ ਹਾਂ ਜਿਹਦੇ ਵਿੱਚ ਕ ਕਲੋਸਟਰੋਲ ਦੀ ਮਾਤਰਾ ਜ਼ਿਆਦਾ ਨਾ ਹੋਵੇ ਇਹ ਤੋਂ ਇਲਾਵਾ ਅਸੀਂ ਖਾਣਾ ਪਕਾਉਣ ਦੇ ਸ ਸਮੇਂ ਸਾਰੇ ਮਸਾਲੇ ਸਾਰੇ ਸਿਹਤ ਦੇ ਸਿਹਤ ਦੀ ਬੈਟਰਮੈਂਟ ਨੂੰ ਧਿਆਨ ਵਿੱਚ ਰੱਖ ਕੇ ਹੀ ਅਸੀਂ ਖਾਣਾ ਪਕਾਉਂਦੇ ਹਾਂ ਧੰਨਵਾਦ